ਮੈਂ ਪੰਜਾਬ ਵਿੱਚ ਰਹਿੰਦੀ ਹਾਂ ਅਤੇ ਪੰਜਾਬ ਜਿਹੜੀ ਹੈ ਉਹ ਗੁਰੂਆਂ ਦੀ ਧਰਤੀ ਹੈ ਇੱਥੇ ਗੁਰੂਆਂ ਨੇ ਜਨਮ ਲਿਤਾ ਇਸ ਕਰਕੇ ਇਹਦੇ ਵਿੱਚ ਜਿਹੜਾ ਸਵਰਨ ਜਿਹੜਾ ਹਰਿਮੰਦਰ ਸਾਹਿਬ ਹੈਗਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸੈਲਾਨੀ ਆਉਂਦੇ ਹਨ ਜੇ ਇੱਥੇ ਅੰਮ੍ਰਿਤਸਰ ਦੇ ਹੀ ਨਹੀਂ ਪੰਜਾਬ ਦੇ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਬਹੁਤ ਜ਼ਿਆਦਾ ਸੈਲਾਨੀ ਆਉਂਦੇ ਹਨ ਉਹਨਾਂ ਦੇ ਸੈਲਾਨੀਆਂ ਦੇ ਰਹਿਣ ਵਾਸਤੇ ਇੱਥੇ ਕਾਫ਼ੀ ਸਰਾਵਾਂ ਅਤੇ ਹੋਟਲ ਵੀ ਖੋਲੇ ਗਏ ਹਨ ਜਿੱਦਾਂ ਕੋਈ ਵਿਦੇਸ਼ ਤੋਂ ਆਉਂਦਾ ਜਿਸ ਸਰਾਂ ਦੇ ਵਿੱਚ ਠਹਿਰਦਾ ਤਾਂ ਉਹਨੂੰ ਮੁਫ਼ਤ ਰੋਟੀ ਵੀ ਮਿਲਦੀ ਹੈ ਜਿੱਦਾਂ ਕਿ ਲੰਗਰ ਗੁਰੂ ਦਾ ਚੱਲਦਾ ਰਹਿੰਦਾ ਹਰਿਮੰਦਰ ਸਾਹਿਬ ਦੇ ਵਿੱਚ ਵੀ ਲੰਗਰ ਦਿਨ ਰਾਤ ਚੱਲਦਾ ਚੌਵੀ ਘੰਟੇ ਤਾਂ ਲੰਗਰ ਉੱਥੇ ਚਲਦਾ ਹੀ ਰਹਿੰਦਾ ਜੇ ਤੁਸੀਂ ਮੰਨ ਲਓ ਕਿ ਹੋਟਲ ਵਿੱਚ ਰਹਿਣਾ ਤਾਂ ਉੱਥੇ ਏ ਸੀ ਨੋਨ ਏ ਸੀ ਹਰ ਤਰ੍ਹਾਂ ਦੇ ਤੁਹਾਨੂੰ ਕਮਰੇ ਮਿਲਣਗੇ ਜੇ ਤੁਸੀਂ ਸਰਾਂ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਹੋਟਲ ਵਿੱਚ ਵੀ ਜਾ ਸਕਦੇ ਹੋ ਉਤੋਂ ਤੁਹਾਡਾ ਵਧੀਆ ਤਾਂ ਵਧੀਆ ਖਾਣਾ ਵੀ ਮਿਲ ਸਕਦਾ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਕੋਲ ਕਾਫ਼ੀ ਜ਼ਿਆਦਾ ਜਿਹੜੇ ਘਰ ਹੈ ਉਹ ਘਰਾਂ ਦੇ ਬਦਲੇ ਕਾਫ਼ੀ ਸਰਾਵਾਂ ਬਣ ਗਈਆਂ ਹਨ ਕਾਫ਼ੀ ਹੋਟਲ ਬਣ ਰਹੇ ਹਨ ਤ ਤਾਂ ਕਿ ਵਿਦੇਸ਼ਾਂ ਤੋਂ ਜਿਹੜੇ ਟੂਰਿਸਟ ਆਉਂਦੇ ਹਨ ਉਹਨਾਂ ਨੂੰ ਰਹਿਣ ਦੀ ਦਿੱਕਤ ਨਾ ਹੋਵੇ ਅਤੇ ਉਹਨਾਂ ਨੂੰ ਗੁਰੂ ਦੀ ਨਗਰੀ ਦੇ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਬਹੁਤ ਸੌਖੇ ਤਰੀਕੇ ਦੇ ਨਾਲ ਹੋ ਜਾਣ ਕਈ ਲੋਕ ਆਉਂਦੇ ਆ ਵਿਦੇਸ਼ਾਂ ਤੋਂ ਜਿਹਦੇ ਜਿਵੇਂ ਕਿ ਉਹ ਹੋਟਲ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ ਉਹਨਾਂ ਨੂੰ ਸਰਾਵਾਂ ਦਾ ਨਹੀਂ ਅੱਛਾ ਲੱਗਦਾ ਹੈਗਾ ਪਰ ਉਹ ਸੈਲਾਨੀ ਜਿਹੜੇ ਹੈਗੇ ਉਹਨਾਂ ਨੂੰ ਇਹ ਨਹੀਂ ਪਤਾ ਸਰਾਂ ਦੇ ਵਿੱਚ ਰਹਿਣ ਦੇ ਨਾਲ ਸਾਨੂੰ ਕਾ ਘੱਟ ਰੇਟ ਮਿਲਦਾ ਹੈ ਸਰਾਂ ਦੇ ਵਿੱਚ ਜਿੱਥੇ ਘੱਟ ਰੇਟ ਹੈ ਉੱਥੇ ਹੀ ਸਾਨੂੰ ਲੰਗਰ ਵੀ ਅਟੁੱਟ ਮਿਲਦਾ ਹੈ ਜਿੰਨਾ ਮਰਜ਼ੀ ਅਸੀਂ ਖਾ ਸਕੀਏ ਅਤੇ ਜਿਹੜੇ ਹੋਟਲਾਂ ਦੇ ਵਿੱਚ ਆ ਉਹਨਾਂ ਦੇ ਉਹਨਾਂ ਨੇ ਕੀਮਤ ਕੀਤੀ ਹੁੰਦੀ ਹੈ ਕਿ ਇਸ ਨੋਨ ਏ ਸੀ ਦੇ ਵਿੱਚ ਰਹਿਣ ਦਾ ਇੰਨਾ ਖ਼ਰਚਾ ਵਾ ਅਤੇ ਏ ਸੀ ਵਿੱਚ ਰਹਿਣ ਦਾ ਇੰਨਾ ਖ਼ਰਚਾ ਆਵੇਗਾ ਇਸ ਕਰਕੇ ਗੁਰੂ ਦੀ ਨਗਰੀ ਦੇ ਵਿੱਚ ਆਉਣ ਵਾਲੇ ਜਿਹੜੇ ਪ੍ਰਿਆਟਕ ਹੈਗੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਇੱਥੇ ਦੇਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਸੈਲਾਨੀ ਜਿਹੜੇ ਹੈ ਗੁਰੂ ਦੀ ਨਗਰੀ ਦੇ ਵਿੱਚ ਆ ਕੇ ਹਰਿਮੰਦਰ ਸਾਹਿਬ ਦੇ ਵਧੀਆ ਦਰਸ਼ਨ ਕਰ ਸਕਣ